ਮੈਂ ਨਵਾਂਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਇੱਥੇ ਮਤਲਬ ਵੀ ਮੈਂ ਪਹਿਲਾਂ ਦੀ ਗੱਲ ਕਰਾਂ ਦਸ ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਤਾਂ ਸਕੂਲ ਅਤੇ ਰੋਡ ਵਗੈਰਾ ਅਤੇ ਗ ਹੋਸਪਿਟਲ ਦੀ ਹਾਲਤ ਠੀਕ ਨਹੀਂ ਸੀਗੀ ਮਤਲਬ ਰੋਡ ਵਗੈਰਾ ਟੁੱਟੀਆਂ ਹੋਈਆਂ ਸੀਗੀਆਂ ਅਤੇ ਹੁਣ ਦੀ ਗੱਲ ਕਰਾਂ ਤਾਂ ਜਿਹੜੇ ਰੋਡਜ਼ ਰੋਡ ਵਗੈਰਾ ਹੈ ਮਤਲਵ ਕਾਫੀ ਵਧੀਆ ਮਤਲਵ ਬਣ ਚੁੱਕੇ ਹੈ ਅਤੇ ਪਹਿਲਾਂ ਦੇ ਜਿਹੜੇ ਜਦੋਂ ਪਹਿਲਾਂ ਦੇ ਜਿਹੜੇ ਨਿਆਣੇ ਸੀ ਮਤਲਵ ਕਿ ਉਹ ਚੰਡੀਗੜ੍ਹ ਵਗੈਰਾ ਵਗੈਰਾ ਪੜ੍ਹਨ ਜਾਂਦੇ ਹੁੰਦੇ ਸੀ ਪਰ ਹੁਣ ਦੀ ਗੱਲ ਕਰਾਂ ਤਾਂ ਇੱਥੇ ਸਕੂਲ ਕੋਲਜਿਜ਼ ਕਾਫੀ ਵਧੀਆ ਹੋ ਗਿਆ ਅਤੇ ਇੱਥੇ ਇੱਥੇ ਪੜ੍ਹਦੇ ਆ ਲੋਕ ਮੈਂ ਖੁਦ ਵੀ ਮਤਲਬ ਇੱਥੇ ਹੀ ਪੜ੍ਹੀ ਹਾਂ ਅਤੇ ਜਿਹੜੇ ਮਤਲਬ ਕਿ ਹੋਸਪਿਟਲ ਇੱਥੇ ਕਾਫੀ ਵਧੀਆ ਤਰੀਕੇ ਨਾਲ ਇਲਾਜ ਵਗੈਰਾ ਹੁੰਦਾ ਆ ਅਤੇ ਮੈਨੂੰ ਮਤਲਬ ਕਿ ਇਹ ਸਾਰੀ ਜਿਹੜੀ ਸਾਰੀ ਜਿਹੜੀ ਪਾਰਟੀਆਂ ਮੈਨੂੰ ਸਾਰੇ ਸਹੀ ਲੱਗਦੀਆਂ ਸਾਰੇ ਵਧੀਆ ਲੱਗਦੀਆਂ ਅਤੇ ਜਿਹੜਾ ਸਾਡਾ ਨਵਾਂਸ਼ਹਿਰ ਦਾ ਐੱਮ ਐੱਲ ਏ ਹੈ ਨਛੱਤਰਪਾਲ ਉਹ ਵੀ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਉਹਨੇ ਕਾਫੀ ਮਤਲਬ ਕਿ ਵਧੀਆ ਨਵਾਂਸ਼ਹਿਰ ਦੇ ਵਿੱਚ ਹਰ ਇੱਕ ਚੀਜ਼ ਵਧੀਆ ਰੱਖੀ ਆ ਜਿੱਦਾਂ ਰੋਡ ਵਗੈਰਾ ਬਣਵਾਇਆ ਹਰ ਇੱਕ ਰੋਡ ਵਗੈਰਾ ਬਣਵਾਇਆ ਅਤੇ ਸਕੂਲ ਵਗੈਰਾ ਕੋਲਜ 'ਚ ਜਿਹੜੀ ਜਿਹੜੀ ਮਤਲਬ ਹਾਲਾਤ ਜਿਹੜੇ ਸੀਗੇ ਮਾੜੇ ਉਹ ਸਹੀ ਕੀਤੇ ਹੈ ਅਤੇ ਮੈਨੂੰ ਉਮੀਦ ਹੈ ਕਿ ਅੱਗੇ ਵੀ ਮਤਲਬ ਇਹ ਚੀਜ਼ ਮਤਲਬ ਕਿ ਚੱਲਦੀ ਰਹੇਗੀ ਵਧੀਆ ਕਰਦੇ ਰਹੇਗੀ ਸਰਕਾਰ ਕਿ ਮਤਲਬ ਕਿ ਸ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਕੂਲ ਵਗੈਰਾ ਹੈ ਮਤਲਬ ਕੋਲਜ ਵਗੈਰਾ ਕਿਤੇ ਲੋਕਾਂ ਨੂੰ ਬਾਹਰ ਨਹੀਂ ਜਾਣਾ ਪੈਣਾ ਪੜ੍ਹਨ ਲਈ ਮਤਲਵ ਇੱਥੇ ਹੀ ਪੜ੍ਹ ਸਕਦੇ ਹਾਂ